ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡੀ ਐਪ ਤੋਂ ਚੂੜੀਆਂ ਮੰਗਵਾਈਆਂ ਸੀ ਜੋ ਕਿ ਮੇਰੇ ਕੋਲ ਪਹੁੰਚ ਚੁੱਕੀਆਂ ਹਨ ਉਹਨਾਂ ਦੀ ਪੈਕਿੰਗ ਬਹੁਤ ਹੀ ਵਧੀਆ ਸੀਗੀ ਅਤੇ ਜਦੋਂ ਮੈਂ ਉਹਨਾਂ ਨੂੰ ਖੋਲ੍ਹ ਕੇ ਦੇਖਿਆ ਤਾਂ ਉਹਨਾਂ ਦੀ ਕੋਐਲਿਟੀ ਬਹੁਤ ਵਧੀਆ ਸੀ ਉਹਨਾਂ ਦਾ ਰੰਗ ਵੀ ਬਹੁਤ ਵਧੀਆ ਸੀ ਮੈਨੂੰ ਉਹ ਚੂੜੀਆਂ ਬਹੁਤ ਹੀ ਸੋਹਣੀਆਂ ਲੱਗੀਆਂ ਅਤੇ ਜਦੋਂ ਮੈਂ ਉਹਨਾਂ ਨੂੰ ਆਪਣੇ ਹੱਥਾਂ 'ਚ ਪਾਇਆ ਤਾਂ ਉਹ ਬਹੁਤ ਹੀ ਲਾਈਟ ਵੇੇਟ ਸੀ ਜਿਵੇਂ ਹੋਰ ਚੂੜੀਆਂ ਹੁੰਦੀਆਂ ਕਿ ਭਾਰੀਆਂ ਮਹਿਸੂਸ ਹੁੰਦੀਆਂ ਉਹਨਾਂ ਵਿੱਚ ਐਵੇਂ ਦਾ ਕੁਝ ਨਹੀਂ ਸੀ ਉਹ ਬਹੁਤ ਹੀ ਹਲਕੀਆਂ ਮਹਿਸੂਸ ਹੋ ਰਹੀਆ ਸੀ ਅਤੇ ਮੈਨੂੰ ਸਾਰੇ ਪੁੱਛ ਰਹੇ ਸੀ ਕਿ ਇਹ ਚੂੜੀਆਂ ਤੂੰ ਕਿੱਥੋਂ ਮੰਗਵਾਈਆਂ ਅਤੇ ਉਸ ਤੋਂ ਬਾਅਦ ਮੈਂ ਕਿਸੇ ਵਿਆਹ 'ਚ ਉਹ ਚੂੜੀਆਂ ਪਾ ਕੇ ਗਈ ਅਤੇ ਉੱਥੇ ਮੇਰੇ ਸਾਰੇ ਫ਼ਰੈਂਡਸ ਨੇ ਮੈਨੂੰ ਪੁੱਛਿਆ ਕਿ ਇਹ ਚੂੜੀਆਂ ਤੂੰ ਕਿੱਥੋਂ ਮੰਗਵਾਈਆਂ ਅਤੇ ਫਿਰ ਮੈਂ ਉਹਨਾਂ ਨੂੰ ਤੁਹਾਡੇ ਐਪ ਬਾਰੇ ਦੱਸਿਆ ਅਤੇ ਉਹਨਾਂ ਨੇ ਵੀ ਤੁਹਾਡੇ ਐਪ ਤੋਂ ਬਹੁਤ ਸਾਰੇ ਔਡਰਜ਼ ਕੀਤੇ ਚੂੜੀਆਂ ਮੰਗਵਾਈਆਂ ਅਤੇ ਉਹਨਾਂ ਨੂੰ ਵੀ ਉਹ ਚੂੜੀਆਂ ਬਹੁਤ ਹੀ ਜ਼ਿਆਦਾ ਵਧੀਆ ਲੱਗੀਆਂ ਪਸੰਦ ਆਈਆਂ ਅਤੇ ਬਹੁਤ ਹੀ ਘੱਟ ਰੇਟ 'ਤੇ ਮਿਲੀਆਂ ਬਹੁਤ ਹੀ ਵਧੀਆ ਸੀ ਅਤੇ ਮੈਂ ਇਹੀ ਰੀਵਿਊ ਦੇਣਾ ਚਾਹੁੰਦੀ ਸੀ ਕਿ ਤੁਹਾਡੀਆਂ ਚੂੜੀਆਂ ਬਹੁਤ ਹੀ ਸੋਹਣੀਆਂ ਲੱਗੀਆਂ ਵਧੀਆ ਲੱਗੀਆਂ ਅਤੇ ਅੱਗੇ ਨੂੰ ਵੀ ਅਸੀਂ ਤੁਹਾਡੇ ਐਪ ਤੋਂ ਔਡਰ ਕਰਾਂਗੇ ਜੀ ਧੰਨਵਾਦ